ਹੈਲੋ ਹੈਲੋ ਹਾਂਜੀ ਨਮਸਕਾਰ ਜੀ ਹਾਂ ਹਾਂਜੀ ਸਰ ਮੈਂ ਮੋਨੀਕਾ ਬੋਲ ਰਹੀ ਹਾਂ ਹਾਂਜੀ ਅੱਛਾ ਅੱਛਾ ਜੀ ਠੀਕ ਹੈ ਸਰ ਹਾਂਜੀ ਅੱਛਾ ਜੀ ਹਾਂਜੀ ਠੀਕ ਹਾਂਜੀ ਸਰ ਕਾਫ ਨਵਾਂ ਸ਼ਹਿਰ 'ਚ ਕਾਫੀ ਸਾਰੇ ਹੋਟਲ ਹੈਗੇ ਹੈ ਰੈਸਟੋਰੈਂਟ ਹੈਗੇ ਆ ਅਤੇ ਜਿਸ ਤਰਾਂ ਮੈਂ ਅਗਰ ਗੱਲ ਕਰਾਂ ਰੇਲੇ ਰੋਡ 'ਤੇ ਰੇਲ ਰੋਡ 'ਤੇ ਵੀ ਕਾਫੀ ਸਾਰੇ ਰੈਸਟੋਰੈਂਟ ਹੈਗੇ ਆ ਭਗਤ ਜੀ ਫਾਸਟ ਫੂਡ ਹੈ ਡੋਲਫੀਨ ਹੈਗੇ ਆ ਇਹਨਾਂ ਦਾ ਫੂਡ ਪੱ ਕਾਫੀ ਵਧੀਆ ਹੈਗਾ ਆ ਅਤੇ ਇਹਨਾਂ ਦੀ ਸਰਵਿਸ ਵੀ ਬਹੁਤ ਅੱਛੀ ਏ ਕਾਫੀ ਵਧੀਆ ਆ ਮੇਨ ਗੱਲ ਕਿ ਟਾਈਮਿੰਗ ਨਹੀਂ ਬਹੁਤੀ ਲਗਾਉਂਦੇ ਹੈਗੇ ਜਲ ਸਰਵਿਸ ਇਹਨਾਂ ਦੀ ਬੜੀ ਫਾਸਟ ਹੈ ਅਗਰ ਤੁਸੀਂ ਸਟੇਅ ਕਰਨਾ ਚਾਹੁੰਦੇ ਹੋ ਹੋਟਲ ਦੀ ਗੱਲ ਮੈਂ ਕਰਾਂ ਤਾਂ ਹੋਟਲ ਨਾ ਚੰਡੀਗੜ੍ਹ ਰੋਡ 'ਤੇ ਹੈ ਪੈਰਿਸ ਹੋਟਲ ਹਾਂਜੀ ਹਾਂਜੀ ਉਹ ਵੀ ਕਾਫੀ ਅੱਛਾ ਆ ਮਤਲਬ ਅੱਛਾ ਸਾਰਾ ਸਟਾਫ਼ ਉਹਨਾਂ ਦਾ ਅਤੇ ਉਹਨਾਂ ਦਾ ਫੂਡ ਵੀ ਬਹੁਤ ਵਧੀਆ ਸਾਰੇ ਕੁਜੀਨ ਹੈਗੇ ਆ ਉਥੇ ਅਤੇ ਇਸ ਤੋਂ ਇਲਾਵਾ ਹਾਂਜੀ ਹਾਂ ਹਾਂਜ ਹਾਂਜੀ ਪਾਰਕਿੰਗ ਹੈਗੀ ਹਾਂਜੀ ਹਾਂਜੀ ਠੀਕ ਏ ਇਧਰ ਬੰਗਾ ਸਾਈਡ ਰੋਡ 'ਤੇ ਵੀ ਕਾਫੀ ਸਾਰੇ ਰੈਸਟੋਰੈਂਟ ਹੈਗੇ ਆ ਹਾਂਜੀ ਹਾਂਜੀ ਤੁਸੀਂ ਇੱਧਰ ਟਰਾਈ ਕਰ ਸਕਦੇ ਹੋ ਅਤੇ ਹੋਵੇਗਾ ਹਾਂਜੀ ਹਾਂਜੀ ਆਪਣੇ ਨਵ ਨਵਾਂ ਸ਼ਹਿਚ ਚੇ ਸਾਰੀ ਫੈਸੀਲੀਟਿਸ ਹੈਗੀਆਂ ਨੇ ਹਾਂਜੀ ਹਾਂਜੀ ਸਰ ਹਾਂਜੀ ਠੀਕ ਹੈ ਸਰ ਕੋਈ ਗੱਲ ਨਹੀਂ ਹਾਂਜੀ ਓ ਹਾਂਜੀ ਓਕੇ ਜੀ ਸਰ ਧੰਨਵਾਦ ਜੀ